ਜੀ ਹਾਂ ਮੈਂ ਆਯੁਸ਼ਮਾਨ ਭਾਰਤ ਯੋਜਨਾ ਬਾਰੇ ਜਾਣਦੀ ਹਾਂ ਇਹ ਭਾਰਤ ਸਰਕਾਰ ਨੂੰ ਇੱਕ ਸਕੀਮ ਸ਼ੁਰੂ ਕੀਤੀ ਸੀ ਦੋ ਹਜ਼ਾਰ ਤੇਈ ਵਿੱਚ ਜਿਸ ਦੇ ਅੰਦਰ ਜਿਨ੍ਹਾਂ ਦੀ ਤਨਖਾਹ ਪੰਜ ਲੱਖ ਤੋਂ ਘੱਟ ਹੈ ਉਹਨਾਂ ਵਾਸਤੇ ਮੁਫ਼ਤ ਇਲਾਜ ਕੀਤਾ ਜਾਵੇਗਾ ਮੈਂ ਤਾਂ ਇਸ ਦਾ ਲਾਭ ਨਹੀਂ ਉਠਾ ਸਕਦੀ ਲੇਕਿਨ ਮੇਰੇ ਆਸ ਪਾਸ ਇੱਥੇ ਅਜਿਹੇ ਬਥੇਰੇ ਲੋਕ ਹਨ ਜੋ ਇਸ ਦਾ ਲਾਭ ਉਠਾਉਂਦੇ ਹਨ ਇਹ ਗਰੀਬਾਂ ਵਾਸਤੇ ਬਹੁਤ ਇੱਕ ਵਧੀਆ ਸਕੀਮ ਹੈ ਜੋ ਕਿ ਭਾਰਤ ਸਰਕਾਰ ਨੇ ਸ਼ੁਰੂ ਕੀਤੀ ਹੈ ਅਸੀਂ ਦੇਖਿਆ ਹੈ ਭਾਰਤ ਵਿੱਚ ਬਹੁਤ ਜ ਅਜਿਹੇ ਲੋਕ ਹਨ ਜੋ ਗਰੀਬੀ ਰੇਖਾ ਅਤੇ ਬਹੁਤ ਘੱਟ ਥੱਲੇ ਰਹਿੰਦੇ ਹਨ ਜੋ ਆਪਣਾ ਇਲਾਜ ਨਹੀਂ ਕਰਵਾ ਸਕਦੇ ਜਿਹੋ ਜਿਹੀਆਂ ਬਿਮਾਰੀਆਂ ਅੱਜ ਕੱਲ੍ਹ ਫੈਲ ਰਹੀਆਂ ਹਨ ਇਹ ਇੱਕ ਨੋਰਮਲ ਇਨਸਾਨ ਲਈ ਹੈ ਉਹ ਇੱਕ ਨੋਰਮਲ ਇਨਸਾਨ ਲਈ ਹੈ ਜ਼ਰੂਰੀ ਨਹੀਂ ਹੈ ਕਿ ਉਸਨੂੰ ਭਰਪੂਰ ਕਰ ਸਕਣ ਇਸ ਕਰਕੇ ਭਾਰਤ ਸਰਕਾਰ ਵੱਲੋਂ ਇਹ ਬਹੁਤ ਵਧੀਆ ਇੱਕ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਜਿਹੜੇ ਘੱਟ ਇਨਕਮ ਵਾਲੇ ਲੋਕ ਹਨ ਉਹ ਇਸ ਦਾ ਲਾਭ ਉਠਾ ਸਕਦੇ ਹਨ ਅਜਿਹੇ ਬਥੇਰੀਆਂ ਬਿਮਾਰੀਆਂ ਦਾ ਇਲਾਜ ਇਸ ਵਿੱਚ ਮੁਫ਼ਤ ਕੀਤਾ ਜਾਂਦਾ ਹੈ ਇਸ ਲੀਏ ਇਸ ਲਈ ਅਸੀਂ ਇਹ ਕਹਿ ਸਕਦੇ ਹਨ ਕਿ ਇਹ ਸਕੀਮ ਇੱਕ ਬਹੁਤ ਵਧੀਆ ਸਕੀਮ ਹੈ ਜਿਸਨੇ ਗਰੀਬ ਲੋਕਾਂ ਦੀ ਬਹੁਤ ਮਦਦ ਕੀਤੀ ਹੈ ਮੇਰੇ ਜਾਣ ਪਹਿਚਾਣ ਵਿੱਚ ਅਜਿਹੇ ਬਹੁਤ ਲੋਕ ਨੇ ਜੋ ਇਸਦਾ ਫ਼ਾਇਦਾ ਉਠਾ ਰਹੇ ਹਨ ਬਥੇ ਲਗਭਗ ਲੱਖਾਂ ਵਿੱਚ ਹੀ ਭਾਰਤ ਸਰਕਾਰ ਨੇ ਆਯੁਸ਼ਮਾਨ ਕਾਰਡ ਬਣਾਏ ਹਨ ਜਿਸ ਦੇ ਰਾਹੀਂ ਲੋਕ ਕਾਡ ਦਿਖਾ ਕਰ ਦਿਖਾ ਕੇ ਉਹਨਾਂ ਦੀ ਵਰਤੋਂ ਨੂੰ ਲੈ ਸਕਦੇ ਹਨ